ਹਾਂਜੀ ਮੇਰੇ ਹਿਸਾਬ ਨਾਲ ਨਿਊਜ਼ ਮੀਡੀਆ ਪੇਂਡੂ ਖੇਤਰਾਂ ਬਾਰੇ ਕਾਫੀ ਮੁੱਦੇ ਦਿਖਾਉਂਦੇ ਹਨ ਜਿੱਦਾਂ ਮੀਡੀਆ ਵਿੱਚ ਸਾਨੂੰ ਪਾਣੀ ਦੇ ਨਿਕਾਸ ਬਾਰੇ ਪਿੰਡਾਂ ਦੇ ਵਿੱਚ ਦਿਖਾਏ ਜਾਂਦੇ ਹਨ ਗਲੀਆਂ ਦਾ ਨਿਕਾਸ ਕਿੱਥੇ ਹੋਇਆ ਹੈ ਇਹ ਵੀ ਵਿਖਾਇਆ ਜਾਂਦਾ ਸੜਕਾਂ ਦੇ ਨਿੱਕਾ ਵਿਕਾਸ ਕਿੱਥੇ ਕਿੱਥੇ ਹੋਏ ਹਨ ਅਤੇ ਸਿਹਤ ਸਬੰਧੀ ਸਕੂਲਾਂ ਸਬੰਧੀ ਦ ਮੇਨ ਮੁੱਦਾ ਜਿਹੜਾ ਨਸ਼ਿਆਂ ਦੇ ਮੁੱਦੇ ਜਿਹੜੇ ਆ ਉਹ ਵੀ ਦਿਖਾਏ ਜਾਂਦੇ ਹਨ ਅਜਿਹੇ ਮੁੱਦੇ ਸਾਨੂੰ ਸ਼ੋਸ਼ਲ ਮੀਡੀਆ ਜਾਂ ਨਿਊਜ਼ ਮੀਡੀਆ ਰਾਹੀਂ ਸਾਡੇ ਘਰਾਂ ਤੱਕ ਪਹੁੰਚਾਏ ਜਾਂਦੇ ਹਨ ਕਿ ਕਿਸ ਤਰ੍ਹਾਂ ਕਿੱਥੇ ਕੀ ਕੀ ਵਿਕਾਸ ਹੋ ਰਿਹਾ ਹੈ ਕੀ ਕੀ ਨਹੀਂ ਹੋ ਰਿਹਾ ਪਰ ਅਸੀਂ ਕੁਛ ਇਹੋ ਜਿਹੇ ਮੁੱਦੇ ਵੀ ਹਨ ਜਿਨ੍ਹਾਂ ਬਾਰੇ ਕੋਈ ਗੱਲਬਾਤ ਕੀਤੀ ਨਹੀਂ ਜਾਂਦੀ ਜਿਸ ਤਰ੍ਹਾਂ ਅੱਜ ਕੱਲ੍ਹ ਪਤਾ ਹੀ ਹੈ ਕਿ ਮੰਦਬੁੱਧੀ ਬੱਚਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਪਰ ਇਹਨਾਂ ਬੱਚਿਆਂ ਪ੍ਰਤੀ ਕੋਈ ਵੀ ਕਿਸੇ ਨੂੰ ਕੋਈ ਜਾਗਰੂਕਤਾ ਨਹੀਂ ਹੈ ਕਿ ਇਹਨਾਂ ਵਾਸਤੇ ਕੋਈ ਪਿੰਡਾਂ ਥਾਵਾਂ ਵਿੱਚ ਸਾਨੂੰ ਸਪੈਸ਼ਲ ਸਕੂਲ ਖੋਲ੍ਹਣੇ ਚਾਹੀਦੇ ਹਨ ਜਿਸ ਵੱਲ ਕਿਸੇ ਵੀ ਮੀਡੀਆ ਦਾ ਕੋਈ ਧਿਆਨ ਨਹੀਂ ਹੈ